ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਾਈ ਜੀ ਸਾਡੇ ਇੱਥੇ ਬੇਕਰੀਆਂ ਤਾਂ ਬਥੇਰੀਆਂ ਜੇ ਤੁਸੀਂ ਵਧੀਆ ਦੀ ਗੱਲ ਕਰੋ ਤਾਂ ਫਿਰ ਇੱਕ ਹਿਮਾਲੇ ਬੇਕਰੀ ਹੈ ਉੱਥੇ ਤੁਹਾਨੂੰ ਸਭ ਕੁਛ ਮਿਲ ਜਾਵੇਗਾ ਭਾਅ ਜੀ ਉੱਧਰ ਖਾਣ ਪੀਣ ਸਭ ਤੋਂ ਵਧੀਆ ਇੱਧਰ ਉਹਦੇ ਕੋਲ ਸਭ ਤੋਂ ਵਧੀਆ ਕੇਕ ਮਿਲ ਜਾਣਗੇ ਤੁਹਾਨੂੰ ਹੋਰ ਵੀ ਬੜਾ ਕੁਛ ਮਿਲ ਜਾਵੇਗਾ ਸ਼ੇਕ ਵਗੈਰਾ ਆਦਿ ਬਰਗਰ ਸਭ ਕੁਛ ਮਿਲ ਜਾਵੇਗਾ ਤੁਹਾਨੂੰ ਉੱਥੇ ਭਾਅ ਜੀ ਉਨ੍ਹਾਂ ਦਾ ਟਾਈਮ ਹੁੰਦਾ ਸਵੇਰੇ ਸਾਢੇ ਨੌ ਤੋਂ ਲੈ ਕੇ ਉਹ ਨੌ ਰਾਤ ਨੌ ਦਸ ਵਜੇ ਤੱਕ ਖੁੱਲ੍ਹੇ ਰਹਿੰਦੇ ਆ ਹਾਂਜੀ